ਅੱਠ ਲੱਖ ਨੱਬੇ ਹਜ਼ਾਰ ਨੌ ਸੌ ਨੱਬੇ ਸੱਤ ਲੱਖ ਸਤੱਤਰ ਹਜ਼ਾਰ ਸੱਤ ਸੌ ਸਤੱਤਰ ਛੇ ਲੱਖ ਛਿਆਹਠ ਹਜ਼ਾਰ ਛੇ ਸੌ ਛਿਆਹਠ ਪੰਜ ਲੱਖ ਪਚਵੰਜਾ ਹਜ਼ਾਰ ਪੰਜ ਸੌ ਪਚਵੰਜਾ ਤਿੰਨ ਲੱਖ ਤੇਤੀ ਹਜ਼ਾਰ ਤਿੰਨ ਸੌ ਤੇਤੀ